ਭਾਰਤ ਵਿੱਚ ਪੂਰੀ ਦੁਨੀਆਂ ਦੇ ਮੁਕਾਬਲੇ ਸਭ ਤੋਂ ਵੱਧ ਧਾਰਮਿਕ ਸਥਾਨ ਹੈ ਜਿਵੇਂ ਕਿ ਪੰਜਾਬ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਹੈ ਇਹਨਾਂ ਮੰਦਿਰਾਂ ਅਤੇ ਗੁਰਦੁਆਰਿਆਂ ਨੂੰ ਦੇਖਣ ਲਈ ਲੋਕ ਵੱਡੀ ਗਿਣਤੀ ਵਿੱਚ ਆਉਂਦੇ ਆ ਜੰਮੂ ਕਸ਼ਮੀਰ ਵਿੱਚ ਸ੍ਰੀ ਮਾਤਾ ਵੈਸ਼ਨੋ ਦੇ ਦੇਵੀ ਜੀ ਦਾ ਭਵਨ ਵੀ ਹੈ ਹਿਮਾਚਲ ਪ੍ਰਦੇਸ਼ ਵਿੱਚ ਨੌ ਦੇਵੀਆਂ ਸਥਾਪਿਤ ਹਨ ਅਤੇ ਉੱਥੇ ਸਿੱਖਾਂ ਦੇ ਕਈ ਗੁਰਦੁਆਰੇ ਵੀ ਹਨ ਜਿਵੇਂ ਕਿ ਸ਼੍ਰੀ ਹੇਮਕੁੰਟ ਸਾਹਿਬ ਸ਼੍ਰੀ ਅ ਅਨੰਦਪੁਰ ਸਾਹਿਬ ਵੀ ਹੈ ਉੱਤਰ ਪ੍ਰਦੇਸ਼ ਵਿੱਚ ਵਰਿੰਦਾਵਨ ਮਥੁਰਾ ਅਤੇ ਅਯੋਧਿਆ ਵੀ ਸਥਾਪਿਤ ਹਨ ਗੁ ਗੁਜਰਾਤ ਵਿੱਚ ਦਵਾਰਕਾ ਸੋਮਨਾਥ ਬਾਜੀ ਪਵਨਗੜ ਅਤੇ ਕਈ ਹੋਰ ਵੀ ਹਨ ਮਹਾਰਾਸ਼ਟਰ ਵਿੱਚ ਸਿੱਖਾਂ ਦਾ ਸਭ ਤੋਂ ਵੱਡਾ ਗੁਰਦੁਆਰਾ ਸ਼੍ਰੀ ਹਜ਼ੂਰ ਸਾਹਿਬ ਨ ਨਾਂਦੇੜ ਹੈ ਵੀ ਸਥਾਪਿਤ ਹਨ ਇੱਦਾਂ ਹੀ ਜੇ ਅਸੀਂ ਗੁਜਰਾਤ ਅਤੇ ਅਹਿਮਦਾਬਾਦ ਸਾਈਡ ਪਾਸੇ ਜਾਈਏ ਤਾਂ ਉੱਥੇ ਪੂਰੀ ਜਗਨ ਨਾਥਪੁਰੀ ਵੀ ਸਥਾਪਿਤ ਹੈ ਜੇ ਅਸੀਂ ਗੱਲ ਕਰੀਏ ਤਾਂ ਸਿੱਖਾਂ ਦੇ ਸਭ ਤੋਂ ਵੱਡੇ ਗੁਰਦੁਆਰੇ ਸ਼੍ਰੀ ਹਰਿਮੰਦਰ ਸਾਹਿਬ ਬਾਰੇ ਗੱਲ ਕਰਨਾ ਕਰਾਂਗੇ ਜਿੱਥੇ ਕਿ ਹਰ ਸਾਲ ਲੱਖਾਂ ਕਰੋੜਾਂ ਗਿਣਤੀ ਵਿੱਚ ਸੰਗਤ ਆਉਂਦੀ ਹੈ ਇਹਨਾਂ ਲਈ ਗੁਰਪੁਰਬ ਇਹਨਾਂ ਦੇ ਗੁਰਦੁਆ ਇਹਨਾਂ ਦੇ ਗੁਰੂਆਂ ਦੇ ਜਨਮ ਦਿਨ ਬਹੁਤ ਹੀ ਧੂਮ ਧਾਮ ਨਾਲ ਮਨਾਏ ਜਾਂਦੇ ਹਨ ਇੱਥੇ ਚੌਵੀ ਘੰਟੇ ਲੰਗਰ ਲਗਾਏ ਜਾਂਦੇ ਹਨ ਗੁ ਦੀਪਮਾਲਾ ਕੀਤੀ ਜਾਂਦੀ ਹੈ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ ਅਤੇ ਹੋਰ ਵੱਖ ਵੱਖ ਤਰੀਕਿਆਂ ਨਾਲ ਜਸ਼ਨ ਮਨਾਏ ਜਾਂਦੇ ਹਨ ਪਰ ਸਭ ਤੋਂ ਖਾਸ ਗੱਲ ਇਹ ਹੈ ਕਿ ਇੱਥੇ ਨਾ ਊਚ ਨੀਚ ਅਮੀਰ ਗਰੀਬ ਕੁਛ ਨਹੀਂ ਦੇਖਿਆ ਜਾਂਦਾ ਸਭ ਨੂੰ ਇੱਕੋ ਤਰ ਇੱਕੋ ਤਰੀਕੇ ਨਾਲ ਲੰਗਰ ਵਰਤਾਇਆ ਜਾਂਦਾ ਹੈ ਅਤੇ ਦਰਸ਼ਨ ਕਰਵਾਏ ਜਾਂਦੇ ਹਨ ਨਾ ਇੱਥੇ ਕੋਈ ਵੀ ਆਈ ਪੀ ਹੈ ਅਤੇ ਨਾ ਕੋਈ ਆਮ ਸਭ ਇੱਕ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼੍ਰੀ ਹਰਿਮੰਦਿਰ ਸਾਹਿਬ ਦੇ ਚਾਰ ਦਰਵਾਜ਼ੇ ਹਨ ਜੋ ਕਿ ਚਾਰ ਵੱਖ ਵੱਖ ਰੀਜਨ ਨੂੰ ਡਿਸ ਉਹ ਮਤਲਬ ਕਿ ਦਰਸ਼ਨ ਕਰਦੇ ਹਨ ਜਿਵੇਂ ਕਿ ਸਿੱਖ ਮੁਸਲਿਮ ਇਸਾਈ ਹਿੰਦੂ ਹੋਰ ਅਸੀਂ ਜੇ ਗੱਲ ਕਰੀਏ ਤਾਂ ਹਰਮੰਦਰ ਸਾਹਿਬ ਤੋਂ ਵੱਡਾ ਗੁਰਦੁਆਰਾ ਕੋਈ ਨਹੀਂ ਹੈ